ਗੱਤਕਾ ਇੱਕ ਜੁਝਾਰੂ ਖੇਡ ਹੈ ਸੋ ਇਸ ਦੇ ਵਿੱਚ ਜੋ ਸਟੈਪ ਹਨ ਇੱਕ ਸਟੈਪ ਜੋ ਦੁਸ਼ਮਣ ਵਾਰ ਕਰਦਾ ਉਸ ਨੂੰ ਰੋਕਣਾ ਅਤੇ ਆਪਣਾ ਵਾਰ ਫੁਰਤੀ ਦੇ ਨਾਲ ਉਸ 'ਤੇ ਭਾਰੂ ਕਰਨਾ ਸੋ ਜੰਗਾਂ ਯੁੱਧਾਂ ਦੇ ਵਿੱਚ ਸੋ ਇਸੇ ਤਰ੍ਹਾਂ ਹੀ ਜੋ ਬਹਾਦਰ ਸਨ ਉਹ ਫੁਰਤੀ ਦੇ ਨਾਲ ਉਹ ਆਪਣੇ ਸ਼ਸਤਰ ਜੋ ਵੀ ਉਹਨਾਂ ਦੇ ਹੱਥ ਦੇ ਵਿੱਚ ਕਿਰਪਾਨ ਡਾਂਗ ਜਾਂ ਬਰਛਾ ਜੋ ਵੀ ਖੰਡੇ ਉਹਨਾਂ ਦੇ ਹੱਥ ਦੇ ਵਿੱਚ ਹੁੰਦੇ ਸਨ ਉਸ ਨੂੰ ਉਹ ਬੜੀ ਫੁਰਤੀ ਦੇ ਨਾਲ ਘੁਮਾਉਂਦੇ ਅਤੇ ਆਪਣੇ ਸਰੀਰ ਨੂੰ ਵੀ ਫੁਰਤੀ ਦੇ ਨਾਲ ਘੁਮਾ ਕੇ ਸੋ ਆਪਣੇ ਦੁਸ਼ਮਣਾਂ 'ਤੇ ਵਾਰ ਕਰਕੇ ਸੋ ਜੰਗਾਂ ਦੇ ਵਿੱਚ ਯੁੱਧਾਂ ਦੇ ਵਿੱਚ ਜਿੱਤਾਂ ਪ੍ਰਾਪਤ ਕਰਦੇ ਸਨ